ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਸ਼ਿਵਮ ਟੂਰ ਟਰੈਵਲ ਤੋਂ ਗੱਲ ਕਰਦੇ ਪਏ ਜੇ ਹੋਰ ਕਿੱਦਾਂ ਘਰ ਸਭ ਠੀਕ ਠਾਕ ਜੇ ਹਾਂਜੀ ਹਾਂਜੀ ਇੱਥੇ ਵੀ ਸਭ ਭਾਅ ਜੀ ਸਭ ਠੀਕ ਠਾਕ ਤੁਸੀਂ ਸੁਣਾਓ ਰਹਿਮਤ ਬਾਬੇ ਦੀ ਭਾਅ ਜੀ ਮੈਂ ਇੱਕ ਹਾਂਜੀ ਹਾਂਜੀ ਉਹ ਪਹਿਚਾਣਿਆ ਹੈਗਾ ਤੁਸੀਂ ਮੈਨੂੰ ਮੈਂ ਅਵੀਨਾਸ਼ਵਰ ਸਿੰਘ ਬੋਲਿਆ ਕਰਨਾ ਹਾਂਜੀ ਹਾਂਜੀ ਜਿਹਨੇ ਕੱਲ੍ਹ ਕੈਬ ਬੁੱਕ ਕਰਵਾਈ ਸੀ ਤੁਹਾਡੇ ਇੱਥੋਂ ਟੂਰ ਟਰੈਵਲਸ ਤੋਂ ਗੁਰਦਾਸਪੁਰ ਤੋਂ ਅੰਬਰਸਰ ਤੱਕ ਜਾਣ ਦੀ ਹਾਂਜੀ ਹਾਂਜੀ ਅਤੇ ਉਹੀ ਕੈਬ ਦੇ ਡਰਾਈਵਰ ਮੈਨੂੰ ਕਿਹਾ ਜਿੱਦਾਂ ਕਿ ਭਾਅ ਜੀ ਨੂੰ ਫੀਡਬੈਕ ਦੇਣਾ ਹੋਏ ਤਾਂ ਕਿੱਦਾਂ ਫੀਡਬੈਕ ਦਈਦਾ ਹੁੰਦਾ ਕਿੱਦਾਂ ਗੱਡੀ ਚਲਾਈ ਉਹਦੇ ਬਾਰੇ ਤੁਸੀਂ ਭਾਅ ਜੀ ਨੂੰ ਦੱਸ ਦਿਓ ਅਤੇ ਉਹੀ ਭਾਅ ਜੀ ਇਹ ਫੀਡਬੈਕ ਦੇਣਾ ਸੀ ਬਸ ਉਹਦਾ ਕਿ ਇਹ ਵੀ ਸੋਹਣੀ ਗੱਡੀ ਚਲਾਈ ਤੁਹਾਡੇ ਡਰਾਈਵਰ ਨੇ ਅਤੇ ਆਹੋ ਉਹੀ ਅਤੇ ਕਿ ਸੋਹਣੀ ਗੱਡੀ ਚਲਾਈ ਹੈ ਤੁਹਾਡੇ ਡਰਾਈਵਰ ਨੇ ਮਤਲਬ ਚੰਗੀ ਟੂਰ ਟਰੈਵਲਸ ਤੁਹਾਡਾ ਹਾਂਜੀ ਹਾਂਜੀ ਭਾਅ ਜੀ ਹਾਂਜੀ ਨਹੀਂ ਨਹੀਂ ਭਾਅ ਜੀ ਉਹ ਤਾਂ ਤੁਹਾਡੇ ਟੂਰ ਟਰੈਵਲਸ ਬਾਰੇ ਵੀ ਮੈਨੂੰ ਮੇਰੇ ਰਿਸ਼ਤੇਦਾਰ ਨੇ ਕਿਸੇ ਨੇ ਦੱਸਿਆ ਸੀ ਨਾ ਉਹ ਵੀ ਹਾਂਜੀ ਹਾਂਜੀ ਉਹ ਵੀ ਤੁਹਾਡੀ ਟੂਰ ਟਰੈਵਲ ਤੋਂ ਕਿਤੇ ਗਏ ਸੀ ਚੰਡੀਗੜ੍ਹ ਗਏ ਸੀ ਅਤੇ ਉਹਦਾ ਤਾਂ ਲੰਬਾ ਸਫਰ ਸੀ ਸਾਡਾ ਤਾਂ ਛੋਟਾ ਹੀ ਸਫਰ ਹੈ ਗੁਰਦਾਸਪੁਰ ਤੋਂ ਅੰਬਰਸਰ ਤੱਕ ਹਾਂਜੀ ਹਾਂਜੀ ਅਤੇ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਰਿਕਮੈਂਡ ਕੀਤਾ ਸੀ ਕਹਿੰਦੇ ਕਿ ਭਾਅ ਜੀ ਤੋਂ ਲਉ ਕੈਬ ਬੜੀ ਸੋਹਣੀ ਕਰਵਾਉਂਦੇ ਆ ਸੋਹਣੇ ਡਰਾਈਵਰ ਰੱਖੇ ਵੇ ਹੈ ਅਤੇ ਉਹੀ ਮੈਂ ਚੱਲ ਦੇਖ ਲੈਂਦੇ ਇੱਕ ਵਾਰੀ ਕਿੱਦਾਂ ਡਰਾਈਵਰ ਵਗੈਰਾ ਇਹਦੇ ਅਤੇ ਉਹੀ ਦੇਖਿਆ ਅਤੇ ਭਾਅ ਜੀ ਬੜੀ ਚੰਗੀ ਲੱਗੀ ਤੁਹਾਡੀ ਡਰਾਈਵਰੀ ਵਗੈਰਾ ਹਾਂ ਹਾਂਜੀ ਭਾਅ ਜੀ ਗੱਡੀ ਵੀ ਬੜੀ ਸਹੀ ਸੀ ਗੱਡੀ ਮਤਲਬ ਕੰਫਰਟੇਬਲ ਗੱਡੀ ਸੀ ਸੈਵਨ ਸੀਟਰ ਮੰਗਵਾਈ ਸੀ ਬੜੀ ਸੋਹਣੀ ਠੀਕ ਠਾਕ ਸੀ ਚੰਗੀ ਸੀ ਗੱਡੀ ਅਤੇ ਕੈਬ ਡਰਾਈਵਰ ਵੀ ਚੰਗਾ ਸੀ ਜਿੱਦਾਂ ਕਈ ਡਰਾਈਵਰ ਹੁੰਦੇ ਨਹੀਂ ਜਿੱਦਾਂ ਖਾਧੀ ਪੀਤੀ 'ਚ ਚਲਾ ਰਹੇ ਹੁੰਦੇ ਆ ਸੀਟ ਬੈਲਟ ਨਹੀਂ ਪਾਈ ਦੀ ਹੁੰਦੀ ਰੈਸ਼ ਡਰਾਈਵਿੰਗ ਬੜੀ ਸਪੀਡ 'ਚ ਗੱਡੀ ਚਲਾ ਰਿਹਾ ਕੋਈ ਨਹੀਂ ਦੇਖਣਾ ਅੱਗੇ ਕੌਣ ਆ ਰਿਹਾ ਕੌਣ ਨਹੀਂ ਵਿੱਚ ਮਾਰ ਦੇਣੀ ਭਾਅ ਜੀ ਕਿਸੇ ਦੇ ਕਿਸੇ ਦੀ ਗੱਲ ਹੀ ਨਹੀਂ ਮੰਨਣੀ ਉਹੋ ਜਿਹਾ ਕੋਈ ਚੱਕਰ ਹੀ ਨਹੀਂ ਸੀ ਭਾਅ ਜੀ ਬੜੀ ਸੋਹਣੀ ਬੜੀ ਪਿਆਰੀ ਗੱਡੀ ਚਲਾਈ ਹੈ ਹਾਂਜੀ ਹਾਂਜੀ ਭਾਅ ਜੀ ਬੜੇ ਪਿਆਰੀ ਹੈ ਕਈ ਹਾਂ ਗਾਣੇ ਲਾਏ ਦੇ ਬੜੇ ਗਾਣੇ ਲਾਏ ਦੇ ਜਿੱਦਾਂ ਰੱਬ ਦੇ ਹਾਂਜੀ ਹਾਂਜੀ ਉਹੀ ਅਰਦਾਸ ਜੀ ਲਾਈ ਦੀ ਸੀ ਅਤੇ ਸੋਹਣੇ ਮਤਲਬ ਕਿ ਸੋਹਣੀ ਗੱਡੀ ਚਲਾਈ ਸੀ ਜਿੱਦਾਂ ਹਾਂਜੀ ਹਾਂਜੀ ਨਹੀਂ ਨਹੀਂ ਭਾਅ ਜੀ ਬੜੀ ਉਹ ਆਰਾਮ ਨਾਲ ਗੱਡੀ ਚਲਾਈ ਹੈ ਸੀਟ ਬੈਲਟ ਪਾਈ ਦੀ ਸੀ ਰਾਤ ਦਾ ਸਮਾਂ ਸੀ ਬੜੇ ਪਿਆਰ ਨਾਲ ਗੱਡੀ ਚਲਾ ਰਹੇ ਸੀ ਕੋਈ ਧੱਕੇਸ਼ਾਹੀ ਨਹੀਂ ਕੋਈ ਗੱਡੀ ਦੀ ਸਪੀਡ ਸਪੂਡ ਨਹੀਂ ਆਰਾਮ ਨਾਲ ਆਉਣ ਜਾਣ ਕਰਿਆ ਕਰਦੇ ਸੀ ਹਾਂਜੀ ਹਾਂਜੀ ਭਾਅ ਜੀ ਉਹੀ ਗੱਲ ਕਰਨੀ ਕਿ ਜਿੱਦਾਂ ਫੀਡਬੈਕ ਉਹੀ ਮੈਨੂੰ ਮੁੰਡਾ ਕਹਿ ਰਿਹਾ ਕਹਿੰਦਾ ਕਿ ਭਾਅ ਜੀ ਨੂੰ ਫੀਡਬੈਕ ਦੇ ਦਿਓ ਅਤੇ ਫੀਡਬੈਕ ਹਾਂਜੀ ਭਾਅ ਜੀ ਫੁੱਲ ਫਾਈਵ ਸਟਾਰ ਭਾਅ ਜੀ ਜਿਹਨੂੰ ਕਹਿੰਦੇ ਭਾਅ ਜੀ ਹੋਰ ਵੀ ਤੁਹਾਡੇ ਕੋਲ ਬੰਦੇ ਲੈ ਕੇ ਆਵਾਂਗੇ ਅਸੀਂ ਜਿਹੜੇ ਜਿਨ੍ਹਾਂ ਨੂੰ ਦੇਣੀ ਹੋਏਗੀ ਹਾਂਜੀ ਹਾਂਜੀ ਹੋਰ ਵੀ ਤੁਹਾਡੇ ਕੋਲ ਕੰਮ ਹਾਂਜੀ ਹੁਣ ਤੁਹਾਡੇ ਕੋਲੋਂ ਕੰਮ ਕਰਵਾਉਣੇ ਹੋਰ ਕਿਸ ਕੋਲੋਂ ਕਰਵਾਉਣੇ ਭਾਅ ਜੀ ਤੁਹਾਡੀ ਇੰਨੀ ਪਿਆ ਇੰਨੀ ਸਹੀ ਗੱਡੀ ਚਲਾਈ ਹੈ ਡਰਾਈਵਰ ਨੇ ਹਾਂਜੀ ਪੂਰੀ ਗੱਲ ਮੰਨੀ ਜੀ ਭਾਅ ਜੀ ਕੋਈ ਜਿੱਦਾਂ ਕਿੱਦਾਂ ਕਿਸੇ ਨੂੰ ਬਾਥਰੂਮ ਬੂਥਰੂਮ ਲੱਗ ਗਿਆ ਉਹ ਭਾਅ ਜੀ ਨੇ ਕਿਹਾ ਤਾਂ ਪੈਟਰੋਲ ਪੰਪ 'ਤੇ ਜਾਣਾ ਉੱਥੇ ਵੀ ਰੋਕਤਾ ਖਾਣ ਪੀਣ ਦਾ ਸਿਸਟਮ ਵੀ ਪੂਰਾ ਠੀਕ ਸੀ ਗੱਡੀ 'ਚ ਏ ਸੀ ਵੀ ਠੀਕ ਠਾਕ ਚੱ ਠੀਕ ਚੱਲਿਆ ਸੀਟ ਬੈਲਟ ਪਾਈ ਸੀ ਡੀਪਰ ਯੂਜ ਕੀਤੇ ਹੋਰਨ ਯੂਜ ਕੀਤੇ ਕੋਈ ਜ਼ਿਆਦਾ ਵਾਧੂ ਸਪੀਡ ਨਹੀਂ ਦਿੱਤੀ ਜਿੱਦਾਂ ਕਈ ਵਾਰੀ ਬੰਦੇ ਦਿੰਦੇ ਹੈ ਸਪੀਡ ਜਿੱਦਾਂ ਸਾਡੀ ਗੱਡੀ ਦੇ ਅੱਗੇ ਇੱਕ ਗੱਡੀ ਚੱਲਿਆ ਦੀ ਸੀ ਉਹ ਵਾਧੂ ਸਪੀਡ 'ਚ ਚੱਲਿਆ ਕਰਦੀ ਖਾਧੀ ਪੀਤੀ 'ਚ ਚੱਲਿਆ ਕਰਦੀ ਨਾਲੇ ਫੋਨ ਚਲਾ ਰਿਹਾ ਸੀ ਉਹ ਅਤੇ ਭਾਅ ਜੀ ਨੇ ਮਤਲਬ ਕਿ ਉਹਨੂੰ ਪਹਿਲਾਂ ਇੱਕ ਸਾਈਡ 'ਤੇ ਖਿਲਾਰ ਕੇ ਪਹਿਲਾਂ ਉਹਦੇ ਨਾਲ ਗੱਲ ਕੀਤੀ ਕਿ ਭਰਾਵਾ ਤੂੰ ਆਪ ਤਾਂ ਐਕਸੀਡੈਂਟ ਕਰਵਾਏਂਗਾ ਕਰਵਾਏਂਗਾ ਨਾਲ ਮੇਰਾ ਵੀ ਕਰਵਾਏਂਗਾ ਅਤੇ ਹਾਂਜੀ ਹਾਂਜੀ ਉਹੀ ਭਰਾ ਗੱਡੀ ਦਾ ਵੀ ਧਿਆਨ ਧਿਯੂਨ ਰੱਖਿਆ ਕਰ ਸੀਟ ਬੈਲਟ ਬੰਨ੍ਹੀ ਦੀ ਆਪਣੀ ਹਾਂਜੀ ਹਾਂਜੀ ਉਹੀ ਤਾਂ ਨਹੀਂ ਭਾਅ ਜੀ ਬੜੇ ਆਰਾਮ ਨਾਲ ਗੱਡੀ ਚਲਾਈ ਹੈ ਗਾਣੇ ਲਾਏ ਦੇ ਬੜੇ ਹੌਲੀ ਹੌਲੀ ਰੱਬ ਦਾ ਨਾਂ ਲ ਲੈ ਲੈ ਕੇ ਚੱਲਿਆ ਕਰਦੇ ਸੀ ਭਾਅ ਜੀ ਹਾਂਜੀ ਭਾਅ ਜੀ ਭਾਅ ਜੀ ਉਹੀ ਫੀਡਬੈਕ ਦੇਣਾ ਸੀ ਇੱਕ ਹਾਂਜੀ ਹਾਂਜੀ ਚਲੋ ਓਕੇ ਫੇਰ ਕਰਨੇ ਫੇਰ ਬਾਅਦ 'ਚੋਂ ਗੱਲ ਫੇਰ ਜੇ ਕੋਈ ਹੋਰ ਵੀ ਅੱਗੇ ਕੋਈ ਕੰਮ ਵਗੈਰਾ ਕਰਵਾਉਣਾ ਹੋਏ ਅਤੇ ਕਿਤੇ ਦੂਰ ਦਾਰ ਦਾ ਚੱਕਰ ਲੱਗਣਾ ਹੋਏ ਤਾਂ ਤੁਹਾਡੇ ਕੋਲ ਹੀ ਆਵਾਂਗੇ ਤੁਹਾਨੂੰ ਹੀ ਸੰਪਰਕ ਕਰਾਂਗੇ ਅਤੇ ਨਾਲੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਤੁਹਾਡੇ ਨਾਲ ਜੋੜਿਆ ਹਾਂਜੀ ਹਾਂਜੀ ਹੁਣ ਸਾਡੇ ਰਿਸ਼ਤੇਦਾਰਾਂ ਨੇ ਵੀ ਚੰਡੀਗੜ੍ਹ ਜਾਣਾ ਸੀ ਨਾ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਅਤੇ ਉੱਧਰੋਂ ਦੀ ਉਹ ਗਏ ਹੈ ਚੰਡੀਗੜ੍ਹ ਅਤੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਸਾਡੀ ਵਾਰੀ ਵੀ ਬੜੇ ਪਿਆਰ ਨਾਲ ਬੜੀ ਸੋਹਣੀ ਗੱਡੀ ਚਲਾਈ ਹੈ ਹਾਂਜੀ ਹਾਂਜੀ ਬੜੇ ਚੰਗੇ ਡਰਾਈਵਰ ਰੱਖੇ ਦੇ ਨੇ ਹੁਣ ਤਾਂ ਇਹੋ ਜਿਹੇ ਚੰਗੇ ਡਰਾਈਵਰ ਲੱਭਦੇ ਹੀ ਨਹੀਂ ਹੁਣ ਤਾਂ ਉਹੀ ਲੱਭਦੇ ਜਿਹੜਾ ਨਸ਼ੇ ਪੱਤੇ ਕਰਕੇ ਤੁਰਦੇ ਵੀ ਹੁੰਦੇ ਹੈ ਹਾਂਜੀ ਨਹੀਂ ਭਾਅ ਜੀ ਕੋਈ ਨਸ਼ਾ ਨਹੀਂ ਕੀਤਾ ਭਾਅ ਨੇ ਕੋ ਕੋਈ ਚੱਕਰ ਨਹੀਂ ਸਾ ਬੜੀ ਸੋਹਣੀ ਅਤੇ ਪਿਆਰੀ ਗੱਡੀ ਚਲਾਈ ਆ ਹਾਂਜੀ ਚਲੋ ਠੀਕ ਆ ਫੇਰ ਭਾਅ ਜੀ ਕਰੋ ਫਿਰ ਕੰਮ ਤੁਸੀਂ ਵੀ ਆਪਣਾ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ